ਬੈਕਿੰਗ ਖੇਤਰ ਵਿੱਚ ਮੇਰਾ ਤਾਂ ਤਰਜੀਬ ਬਹੁਤ ਵਧੀਆ ਹੈ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਹੋ ਹੀ ਕਵਾਂਗਾ ਕਿ ਬੈਂਕਿੰਗ ਸਿਸਟਮ ਵਿੱਚ ਜ਼ਿਆਦਾ ਧਿਆਨ ਦੇਣ ਉਸ ਦਾ ਸੋਚ ਉਸਦੇ ਨੈਟ ਬੈਂਕਿੰਗ ਯੂਜ਼ ਕਰਨ ਤਾਂ ਕਿ ਅੱਜ ਕੱਲ ਬੈਂਕ ਨੇ ਬਹੁਤ ਸਹੂਲਤਾਂ ਕਰ ਦਿੱਤੀਆਂ ਹਨ ਘਰ ਬੈਠੇ ਹੀ ਸਾਰੀ ਪੇਮੈਂਟ ਡਿਜੀਟਲ ਪੇਮੈਂਟ ਹੋ ਜਾਂਦੀ ਹੈ ਇਸ ਲਈ ਨੈ ਮੈਂ ਅਤੇ ਬੱਚੇ ਆਪਣਿਆਂ ਨੂੰ ਇਹੋ ਹੀ ਕਵਾਂਗਾ ਕਿ ਨੈਟ ਬੈਂਕਿੰਗ ਸਹੂਲਤ ਦਾ ਪੂਰਾ ਫਾਇਦਾ ਲਓ ਮੇਰਾ ਅਤੇ ਮੇਰੀ ਆਦਰਸ਼ ਭੂਮਿਕਾ ਇਹੀ ਹੋਵੇਗੀ ਕਿ ਮੈਂ ਆਪਣੇ ਬੱਚਿਆਂ ਨੂੰ ਸਮਝਾਵਾਂ ਕਿਵੇਂ ਅੱਜ ਕੱਲ ਨੈੱਟ ਬੈਂਕਿੰਗ ਬਹੁਤ ਜ਼ਰੂਰੀ ਹੈ ਜੇ ਨਾ ਸਮਝਣਗੇ ਫਿਰ ਵੀ ਮੈਂ ਪਿਆਰ ਨਾਲ ਉਹਨਾਂ ਨੂੰ ਸਮਝਾ ਕੇ ਇਸ ਨੂੰ ਕਵਾਂਗਾ ਕਿ ਪੜੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕੀ ਅੱਜ ਕੱਲ ਪੜ੍ਹਾਈ ਬਹੁਤ ਜ਼ਰੂਰੀ ਹੈ ਇਸ ਲਈ ਨੈ ਬੈਂਕਿੰਗ ਤੋਂ ਬਗੈਰ ਨੈੱਟ ਬੈਂਕਿੰਗ ਤੋਂ ਬਗੈਰ ਕੋਈ ਸਹੂਲਤ ਵੀ ਨਹੀਂ ਮਿਲਦੀ ਇਸ ਲਈ ਮੈਂ ਉਹਨਾ ਉਤਸਾ ਉਤਸ਼ਾਹਿਤ ਕਰਾਂਗਾ ਕਿ ਉਹ ਨੈੱਟ ਬੈਕਿੰਗ ਯੂਜ਼ ਕਰਨ ਤਾਂ ਕਿ ਉਸ ਉਹਨਾਂ ਉਹਨਾਂ ਨੂੰ ਇਸ ਦੀ ਸਹੂਲਤ ਬਾਰੇ ਪਤਾ ਲੱਗੇ ਕ੍ਰੈਡਿਟ ਕਾਰਡ ਦੀ ਪੇਮੈਂਟ ਵੀ ਆਰਾਮ ਨਾਲ ਹੋ ਜਾਂਦੀ ਹੈ ਕਈ ਸਹੂਲਤਾਂ ਅੱਜ ਕੱਲ ਨੈੱਟ ਬੈਂਕਿੰਗ ਆਰਾਮ ਨਾਲ ਦੇ ਰਿਹਾ ਹੈ ਇਸ ਲਈ ਆਪਣੇ ਬੱਚਿਆਂ ਨੂੰ ਪੂਰਾ ਉਤਸ਼ਾਹਿਤ ਕਰਾਂਗਾ ਕੀ ਇਸ ਦਾ ਫਾਇਦਾ ਪੂਰਾ ਪੂਰਾ ਲੈਣ